ਸਤਿ ਸ਼੍ਰੀ ਅਕਾਲ ਮੈਂ ਪ੍ਰੇਰਨਾ ਗੱਲ ਕਰਨਦੀ ਹਾਂ ਪਠਾਨਕੋਟ ਜਿਲ੍ਹੇ ਤੋਂ ਕੀ ਤੁਸੀਂ ਐਮਾਜ਼ੋਨ ਤੋਂ ਗੱਲ ਕਰਨਦੇ ਹੋ ਮੈਂ ਤੁਹਾਡੀ ਜਾਣਕਾਰੀ ਵਿੱਚ ਇਹ ਲਿਆਉਣਾ ਚਾਹੁੰਦੀ ਹਾਂ ਕਿ ਮੈਂ ਐਮਾਜ਼ੋਨ ਦੀ ਨਵੀਂ ਕਸਟਮਰ ਹਾਂ ਅਤੇ ਮੈਂ ਸਿਰਫ਼ ਦੋ ਵਾਰ ਹੀ ਇਸ ਐਮਾਜ਼ੋਨ ਤੋਂ ਪ੍ਰੋਡਕਟ ਮੰਗਵਾਏ ਨੇ ਅਤੇ ਦੋਨਾਂ ਵਾਰ ਹੀ ਮੇਰੇ ਨਾਲ ਧੋਖਾ ਹੋਇਆ ਹੈ ਅਤੇ ਐਮਾਜ਼ੋਨ ਨੇ ਮੈਨੂੰ ਨਿਰਾਸ਼ ਕੀਤਾ ਹੈ ਪਹਿਲਾਂ ਪਹਿਲੀ ਵਾਰ ਮੈਂ ਐਮਾਜ਼ੋਨ ਤੋਂ ਆਪਣੇ ਨਿੱਕੇ ਭਰਾ ਲਈ ਇੱਕ ਨੁਆਇਸ ਦੀ ਘੜੀ ਮੰਗਵਾਈ ਸੀ ਜਿਸ ਦੀ ਕੀਮਤ ਚੌਦਾਂ ਹਜ਼ਾਰ ਸੀ ਅਤੇ ਉਸਦਾ ਰੰਗ ਕਾਲਾ ਸੀ ਮੈਂ ਤੇ ਮੇਰਾ ਭਰਾ ਬਹੁਤ ਖੁਸ਼ ਸਨ ਪਰ ਐਮਾਜ਼ੋਨ ਨੇ ਸਾਨੂੰ ਨਿਰਾਸ਼ ਕਰ ਦਿੱਤਾ ਜਿਸ ਦਿਨ ਮੈਂ ਘੜੀ ਲੈਣ ਗਈ ਤਾਂ ਜੋ ਡਿਲੀਵਰੀ ਕਰਨ ਆਇਆ ਸੀ ਉਹ ਮੇਰੇ ਨਾਲ ਬਹੁਤ ਚੰਗਾ ਪੇਸ਼ ਆਇਆ ਬਹੁਤ ਚੰਗਾ ਪੇਸ਼ ਆਇਆ ਸੀ ਪਰ ਜਦੋਂ ਮੈਂ ਬੋਕਸ ਲੈ ਕੇ ਉੱਥੋਂ ਚੱਲ ਗਈ ਅਤੇ ਘਰ ਜਾ ਕੇ ਅਨਬੋਕਸ ਕੀਤਾ ਕਰਨ ਲੱਗੀ ਤਾਂ ਅਸੀਂ ਦੇਖਿਆ ਕੀ ਡੱਬਾ ਪੂਰਾ ਖਾਲੀ ਸੀ ਅਤੇ ਉਸ ਵਿੱਚ ਕੋਈ ਘੜੀ ਨਹੀਂ ਸੀ ਇਹ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਅਤੇ ਮੈਂ ਇਸਦੀ ਇੱਕ ਵਾਰ ਮੈਂ ਕੰਪਲੇਨ ਵੀ ਕੀਤੀ ਸੀ ਪਰ ਮੈਨੂੰ ਉਸਦਾ ਉਸਦਾ ਕੋਈ ਰਿਸਪੋਂਸ ਨਹੀਂ ਆਇਆ ਫਿਰ ਮੈਂ ਇਸ ਗੱਲ 'ਤੇ ਮਿੱਟੀ ਪਾ ਤੀ ਫਿਰ ਮੈਂ ਸੋਚਿਆ ਕਿ ਕੋ ਇੱਕ ਵਾਰ ਹੋਰ ਕੋਸ਼ਿਸ਼ ਕਰਨੀ ਕੁਝ ਹੋਰ ਮੰਗਵਾ ਕੇ ਵੇਖਣੀ ਹੁਣ ਫਿਰ ਹਫ਼ਤੇ ਪਹਿਲਾਂ ਹੀ ਮੈਂ ਆਪਣੇ ਆਪਣੇ ਲਈ ਇੱਕ ਬੋਲਟ ਦੇ ਹੈਡਫੋਨ ਮੰਗਵਾਏ ਸੀ ਹੈਡਫੋਨ ਮੰਗਵਾਇਆ ਸੀ ਤੇ ਸੋਚ ਉਹਨੂੰ ਕਿ ਉਹਨਾਂ ਸਾਡੇ ਨਾਲ ਹੋਰ ਅਤੇ ਸੋਚਿਆ ਕਿ ਹੁਣ ਸਾਡੇ ਨਾਲ ਧੋਖਾ ਨਾ ਹੋਵੇ ਪਰ ਇਸ ਵਾਰ ਜਦੋਂ ਪਾਰਸਲ ਲੈਣ ਗਈ ਤਾਂ ਘਰ ਆ ਕੇ ਅਨਬੋਕਸ ਕੀਤਾ ਉਸ ਵਿੱਚ ਹੈਡਫੋਨ ਹੈਗੇ ਸੀ ਇਹ ਦੇਖ ਕੇ ਮੈਂ ਅਤੇ ਮੇਰਾ ਭਰਾ ਦੋਨੋਂ ਬਹੁਤ ਖੁਸ਼ ਸੀ ਪਰ ਜਦੋਂ ਮੈਂ ਹੈਡਫੋਨ ਇਸਤੇਮਾਲ ਕੀਤਾ ਤਾਂ ਉਸ ਦੀ ਕੁਆਲਿਟੀ ਬਹੁਤ ਘਟੀਆ ਸੀ ਜਿਸ ਪ੍ਰਕਾਰ ਉਹਨਾਂ ਨੇ ਦੱਸਿਆ ਸੀ ਉਸ ਤੋਂ ਪੂਰਾ ਉਲਟ ਸੀ ਅਤੇ ਦੋ ਦਿਨਾਂ ਬਾਅਦ ਹੀ ਉਹ ਹੈਡਫੋਨ ਖਰਾਬ ਹੋ ਗਏ ਅਤੇ ਇੱਦਾਂ ਲੱਗ ਰਿਹਾ ਸੀ ਉਸ ਦੇ ਉੱਪਰ ਪੇਂਟ ਕੀਤਾ ਗਿਆ ਹੈ ਅਤੇ ਉਹ ਪੁਰਾਣੇ ਨੇ ਉਸ ਦੀ ਕੀਮਤ ਬਾਰਾਂ ਰੋ ਬਾਰਾਂ ਸੌ ਰੁਪਏ ਬਾਰਾਂ ਕੁ ਸੌ ਰੁਪਏ ਸੀ ਅਤੇ ਰੰਗ ਚਿੱਟਾ ਸੀ ਇਸ ਦੇ ਚੱਕਰ ਵਿੱਚ ਮੈਨੂੰ ਘਰ ਵਾਲਿਆਂ ਤੋਂ ਝਿੜਕਾਂ ਝਿੜਕਾਂ ਵੀ ਬਹੁਤ ਖਾਣੀਆਂ ਪਈਆਂ ਅਤੇ ਮੈਂ ਹੁਣ ਤੁਹਾਨੂੰ ਇਸ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਮੇਰੀ ਕੰਪਲੇਂਟ ਨੂੰ ਸੀਰੀਅਸਲੀ ਲਿਆ ਜਾਵੇ ਤਾਂ ਕਿ ਮੈਨੂੰ ਜਲਦ ਤੋਂ ਜਲਦ ਜਵਾਬ ਦਿੱਤਾ ਜਾਵੇ ਅਤੇ ਜਾਂ ਫਿਰ ਮੇਰੇ ਪੈਸਿਆਂ ਨੂੰ ਕੰਪਨਸੇਟ ਕੀਤਾ ਜਾਵੇ ਅਸੀਂ ਬਹੁਤ ਹੀ ਦਿਲ ਲੈ ਕੇ ਤੁਹਾਡੇ ਕੋਲੋਂ ਕੁਝ ਮੰਗਵਾਉਂਦੇ ਹਾਂ ਅਤੇ ਜਦੋਂ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਤਾਂ ਫਿਰ ਸਾਡਾ ਉਸ ਤੋਂ ਬਾਅਦ ਦਿਲ ਨਹੀਂ ਕਰਦਾ ਕਿ ਅਸੀਂ ਕੁਝ ਹੋਰ ਮੰਗਵਾਈਏ ਇਸ ਕਰਕੇ ਇਹ ਧੋਖਾ ਕਰਨਾ ਬੰਦ ਕੀਤਾ ਬੰਦ ਕਰੋ ਤਾਂ ਕਿ ਅਸੀਂ ਔਨਲਾਈਨ ਪਲੈਟਫੋਮ 'ਤੇ ਭਰੋਸਾ ਕਰ ਸਕੀਏ ਅਤੇ ਆਪਣੇ ਪੈਸੇ ਬਚਾ ਸਕੀਏ ਧੰਨਵਾਦ